ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੋਹਾਲੀ ਤੋਂ ਬੋਲਦੇ ਹੋ ਅਸੀਂ ਬੰਬੇ ਤੋਂ ਗੱਲ ਕਰਦੇ ਸੀ ਸਰ ਅਸੀਂ ਘੁੰਮਣ ਆਉਣਾ ਹੈ ਜੀ ਮੋਹਾਲੀ ਤੁਸੀਂ ਟੂਰਿਸਟ ਨੂੰ ਅੱਗੇ ਉਹ ਕਰ ਦੇ ਹੋ ਗੱਲ ਅੱਛਾ

ਅਤੇ ਸਾਨੂੰ ਤੁਸੀਂ ਜਗ੍ਹਾ ਦੱਸ ਸਕਦੇ ਹੋ ਆਪਣੀ ਇੱਥੇ ਕਿਹੜੀ ਕਿਹੜੀ ਘੁੰਮਣ ਨੂੰ ਹੈ ਆਪਣੀ ਨੇੜੇ ਅੱਛਾ ਜੀ ਅੱਛਾ ਜੀ ਅਤੇ ਆਪਣਾ ਰੈਸਰੋਰੈਂਟ ਤੁਸੀਂ ਪ੍ਰੋਵਾਇਡ ਕਰਕੇ ਦੇਵੋਂਗੇ ਜੀ ਰਹਿਣ ਵਾਸਤੇ ਅੱਛਾ ਅੱਛਾ ਆਪਣਾ ਅਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਦੱਸ ਪਰਾਇਜ਼ ਪਰੂਇਜ਼ ਕੀ ਹੈ ਆਪਣਾ ਇੱਥੇ ਦਾ ਜਿਵੇਂ ਸਾਰਾ ਵਿੱਚ ਤੁਹਾਡਾ ਘੁੰਮਣਾ ਸਾਡਾ ਅਤੇ ਰਹਿਣ ਸਹਿਣ ਦਾ ਵਿੱਚ ਖਾਣ ਪੀਣ ਦਾ ਅਸੀਂ ਇੱਕ ਵੀਕ ਲਈ ਆਉਣਾ ਜੀ ਫ਼ਰੈਡਸ ਨਾਲ਼ ਅਸੀਂ ਚਾਰ ਹੈਂਗੇ ਚਾਰ ਜਣੇ ਅੱਛਾ ਜੀ ਆਪਣੀ ਕੋਈ ਇਹ ਆਪਣੀ ਔਫ਼ ਔਫ਼ ਊਫ਼ ਤਾਂ ਨਹੀਂ ਹੈ ਕੋਈ ਲੈੱਸ ਲੁੱਸ

ਅੱਛਾ ਅੱਛਾ ਅੱਛਾ ਜੀ ਆਪਣੇ ਮਤਲਬ ਤੁਸੀਂ ਅਸੀਂ ਤੁਸੀਂ ਸਿਸਵਾ ਡੈਮ ਦਿਖਾਉਗੇ ਅਸੀਂ ਆਹ ਵੀ ਵੇਖਿਆ ਇਹ ਵੀ ਬਹੁਤ ਸੋਹਣੀ ਪਲੇਸ ਹੈ ਆਪਣੀ ਇੱਧਰ

ਅਤੇ ਅੱਛਾ ਜੀ ਆਹ ਫੇਰ ਮਤਲਬ ਜੇ ਅਸੀਂ ਨਾਈਟ ਨੁਈਟ ਨੂੰ ਘੁੰਮਣ ਜਾਣਾ ਕੋਈ ਚੱਕਰ ਨਹੀਂ ਹੈ ਓਕੇ ਸਰ ਥੈਂਕ ਯੂ ਤੁਸੀਂ ਆਪਣਾ ਨੰਬਰ ਸੈਂਡ ਕਰ ਦਿਉ ਫਿਰ ਤੁਹਾਨੂੰ ਅਸੀਂ ਕਾਲ ਕਰ ਦੇਵਾਂਗੇ ਜਦੋਂ ਆਉਣਾ ਹੋਇਆ